ਪਹਿਲਾਂ ਕੁਛ ਸਮੇਂ ਪਹਿਲਾਂ ਜਿਵੇਂ ਕਿ ਆਪਾਂ ਲਗਾ ਸਕਦੇ ਹਾਂ ਦੋ ਜਾਂ ਤਿੰਨ ਮਹੀਨੇ ਪਹਿਲਾਂ ਮੈਂ ਪਿੰਡ ਤੋਂ ਬਾਹਰ ਯਾਤਰਾ ਕੀਤੀ ਸੀ ਅਤੇ ਉਹ ਯਾਤਰਾ ਅਸੀਂ ਪਟਨਾ ਸਾਹਿਬ ਦੀ ਯਾਤਰਾ ਸੀ ਉੱਥੇ ਜਾ ਕੇ ਮੈਨੇ ਜਿਵੇਂ ਕਿ ਆਪਾਂ ਲਗਾ ਸਕਦੇ ਹਾਂ ਕਿ ਕਾਫੀ ਸਾਰੀਆਂ ਪ੍ਰੋਬਲਮ ਸੀਗੀਆਂ ਜਿਹੜੀਆਂ ਮੈਂ ਫੇਸ ਕੀਤੀਆਂ ਸੀਗੀਆਂ ਉਹਦੇ ਵਿੱਚ ਸਭ ਤੋਂ ਪਹਿਲਾਂ ਪ੍ਰੋਬਲਮ ਇਹ ਸੀਗੀ ਨੈਟਵਰਕ ਇਸ਼ੂ ਨੈਟਵਰਕ ਇਸ਼ੂ ਬਹੁਤ ਜ਼ਿਆਦਾ ਆ ਰਿਹਾ ਸੀ ਮਤਲਬ ਇੱਕ ਦੂਜੇ ਨਾਲ ਕੰਟੈਕਟ ਕਰਨਾ ਬਹੁਤ ਜ਼ਿਆਦਾ ਔਖਾ ਹੋ ਰਿਹਾ ਸੀ ਅਤੇ ਚੱਲੋ ਇਹ ਤਾਂ ਟੈਕਨੋਲੋਜੀ ਦੇ ਰਿਲੇਟਡ ਇੱਕ ਪ੍ਰੋਬਲਮ ਹੋ ਗਈ ਬਟ ਜੇ ਆਪਾਂ ਦੇਖੀਏ ਤਾਂ ਮੌਸਮ ਦੀ ਪ੍ਰੋਬਲਮ ਵੀ ਬਹੁਤ ਜ਼ਿਆਦਾ ਸੀ ਜਿਵੇਂ ਕਿ ਪੰਜਾਬ ਦੇ ਵਿੱਚ ਸੀ ਜਿਹੜੀ ਉਸ ਟਾਈਮ ਦੇ ਵਿੱਚ ਗਰਮੀ ਬਹੁਤ ਜ਼ਿਆਦਾ ਘੱਟ ਸੀਗੀ ਬਟ ਜਦੋਂ ਆਪਾਂ ਬਿਹਾਰ ਜਾਂ ਪਟਨਾ ਸਾਹਿਬ ਦੇਖਿਆ ਉੱਥੇ ਕਾਫੀ ਜ਼ਿਆਦਾ ਗਰਮੀ ਸੀ ਜਿਹਦੇ ਕਰਕੇ ਉਹ ਸਿਹਤ ਨੂੰ ਇੱਕਦਮ ਇਫੈਕਟ ਕੀਤਾ ਅਤੇ ਫਿਰ ਆਉਂਦੇ ਹੋਏ ਜਿਵੇਂ ਮੈਂ ਕਾਫੀ ਸਾਰੀਆਂ ਚੀਜ਼ਾਂ ਨੋਟ ਕੀਤੀਆਂ ਅਤੇ ਜਿੱਦਾਂ ਆਉਂਦੇ ਹੋਏ ਬਾਏ ਰੇਲ ਟਰੈਵਲ ਕੀਤਾ ਸੀ ਅਤੇ ਉੱਥੇ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਆ ਰਹੀ ਸੀ ਉਸ ਸਾਫ ਸਫਾਈ ਦੀ ਪ੍ਰੋਬਲਮ ਸੀਗੀ ਉਹਨਾਂ ਪਲੈਟਫਾਮਸ ਦੇ ਉੱਤੇ ਕਿ ਉਹ ਹਾਈਜੈਨਿਕ ਕੰਡੀਸ਼ਨਸ ਨਹੀਂ ਸੀਗੀਆਂ ਉੱਥੇ ਅਤੇ ਫਿਰ ਜੇ ਆਪਾਂ ਲਗਾ ਦਈਏ ਕਿ ਰੇਡ ਦੀ ਪ੍ਰੋਬਲਮ ਜਿਵੇਂ ਕਿ ਉਹ ਬਾਹਰ ਵਾਲੇ ਲੋਕਾਂ ਨੂੰ ਜਿਹੜੇ ਕਿ ਆਊਟ ਆਫ ਸਟੇਟ ਸੀਗੇ ਉਹਨਾਂ ਨੂੰ ਕਾਫੀ ਜਿਆਦਾ ਜਿਹੜੀਆਂ ਚੀਜ਼ਾਂ ਸੀਗੀਆਂ ਉਹ ਪ੍ਰਾਈਜ ਦੇ ਕੰਪੈਰੀਜ਼ਨ ਉਹ ਬਹੁਤ ਜ਼ਿਆਦਾ ਓਵਰ ਚਾਰਜ ਕਰ ਰਹੇ ਸੀਗੇ ਸੋ ਬੇਸਿਕਲੀ ਇਹ ਮੈਂ ਪ੍ਰੋਬਲਮ ਸੀ ਜਿਹੜੀਆਂ ਫੇਸ ਕੀਤੀਆਂ